ਹਾਂਜੀ ਵੀਰੇ ਜਿਵੇਂ ਤੁਸੀਂ ਪੁੱਛਿਆ ਹੈਗਾ ਕਿ ਪਿੰਡਾਂ ਦੇ ਲੋਕ ਆਪਣੀਆਂ ਰਵਾਇਤੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮਨੋਰੰਜਨ ਦੇ ਆਧਾਰਿਤ ਰੂਪਾਂ ਵਿੱਚ ਹੈ ਨਾ ਤਾਂ ਪਹਿਲਾਂ ਜੋ ਕਿ ਪਹਿਲਾਂ ਦਾ ਸਮਾਂ ਸੀਗਾ ਪਹਿਲਾਂ ਲੋਕ ਇੱਕ ਘਰ ਦੇ ਵਿੱਚ ਬੈਠ ਕੇ ਹੈ ਨਾ ਇੱਕ ਘਰ ਦੇ ਵਿੱਚ ਬੈਠ ਕੇ ਕੋਈ ਵੀ ਫੰਕਸ਼ਨ ਹੁੰਦਾ ਜਾਂ ਜਿੱਦਾਂ ਕੋਈ ਤਿਉਹਾਰ ਲਾ ਲਓ ਹੈ ਨਾ ਪਹਿਲਾਂ ਇੱਕ ਘਰ ਦੇ ਵਿੱਚ ਕਈ ਕਈ ਘਰ ਮਿਲ ਜੁਲ ਕੇ ਮਨਾਉਂਦੇ ਤਿਉਹਾਰ ਨੂੰ ਹੈ ਨਾ ਤਾਂ ਉਹ ਜਸ਼ਨ ਮਨਾ ਲੈਂਦੇ ਸੀ ਸਾਰੇ ਘਰ ਰਲ ਕੇ ਜਿੱਦਾਂ ਅੱਠ ਅੱਠ ਨੌ ਨੌ ਘਰ ਰਲ ਕੇ ਇੱਕ ਘਰ ਦੇ ਵਿੱਚ ਜਸ਼ਨ ਮਨਾਇਆ ਕਰਦੇ ਸੀ ਤਾਂ ਕਿੰਨਾ ਜ਼ਿਆਦਾ ਵਧੀਆ ਫੀਲ ਹੁੰਦਾ ਸੀਗਾ ਅੱਜ ਕੱਲ੍ਹ ਲੋਕ ਕੀ ਕਰਦੇ ਹੈਗੇ ਤਿੱਥਾਂ ਤਿਉਹਾਰਾਂ ਦੇ ਉੱਪਰ ਬਾਹਰ ਜਾਂਦੇ ਹੈਗੇ ਕਲੱਬਾਂ ਦੇ ਵਿੱਚ ਜਾਂਦੇ ਹੈਗੇ ਆ ਸ਼ਰਾਬਾਂ ਪੀਂਦੇ ਹੈਗੇ ਆ ਸ਼ਰਾਬਾਂ ਪੀਣਾ ਜਿੱਦਾਂ ਹੈ ਨਾ ਹੋਰ ਵੀ ਨਸ਼ੇ ਆ ਗਏ ਆ ਉਹ ਕਰਦੇ ਹੈਗੇ ਆ ਰਲ ਮਿਲ ਕੇ ਤਾਂ ਉਹ ਕਲੱਬਾਂ ਦੇ ਵਿੱਚ ਜਾ ਕੇ ਆਪਣੀ ਹੀ ਸਿਹਤ ਖਰਾਬ ਕਰਦੇ ਹੈਗੇ ਆ ਜਿਹੜੇ ਕਿ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਬਿਲਕੁਲ ਵੀ ਨਹੀਂ ਸੀਗਾ ਵਧੀਆ ਸਿਹਤ ਸੀਗਾ ਅੱਜ ਕੱਲ੍ਹ ਦੇ ਵਿੱਚ ਨਸ਼ਾ ਕਰਕੇ ਲੋਕ ਉੱਥੇ ਕਲੱਬਾਂ ਦੇ ਵਿੱਚ ਆਪਣਾ ਜਿਵੇਂ ਵੱਡੇ ਵੱਡੇ ਕਲੱਬ ਨੇ ਹੈ ਨਾ ਉੱਥੇ ਫਾਲਤੂ ਦਾ ਪੈਸਾ ਬਰਬਾਦ ਕਰਦੇ ਹੈਗੇ ਆ ਪਹਿਲਾਂ ਤਾਂ ਉਹ ਫਿਰ ਆਪਣੀ ਸਿਹਤ ਵੱਲ ਵੀ ਨਹੀਂ ਦੇਖਦੇ ਹੈਗੇ ਮੈਨੂੰ ਲੱਗਦਾ ਕਿ ਪਹਿਲਾਂ ਵਾਲੇ ਜ਼ਮਾਨਿਆਂ ਦੇ ਵਿੱਚ ਜਿੱਦਾਂ ਕਿ ਪਹਿਲਾਂ ਅਸੀਂ ਪਿਛਲੇ ਜ਼ਮਾਨਿਆਂ ਦੇ ਵਿੱਚ ਸੀਗਾ ਜਿੱਦਾਂ ਇੱਕ ਘਰ ਦੇ ਵਿੱਚ ਬੈਠ ਕੇ ਹੀ ਸਾਰਿਆਂ ਦਾ ਜਿਹੜਾ ਕਿ ਜਸ਼ਨ ਮਨਾਇਆ ਜਾਂਦਾ ਤਾਂ ਉਹ ਸਭ ਨੂੰ ਵਧੀਆ ਵੀ ਲੱਗਦਾ ਸੀਗਾ ਅੱਜ ਕੱਲ੍ਹ ਦਾ ਮੈਨੂੰ ਮਾਹੌਲ ਬਿਲਕੁਲ ਵੀ ਸਹੀ ਨਹੀਂ ਲੱਗ ਰਿਹਾ ਹੈਗਾ